ਹੈਲੋ ਹਾਂਜੀ ਜੇ ਆਪਾਂ ਟੀ ਵੀ ਖਬਰਾਂ ਦੀ ਗੱਲ ਕਰੀਏ ਤਾਂ ਮੈਂ ਮਤਲਬ ਕਿ ਖਬਰਾਂ ਬਹੁਤ ਜ਼ਿਆਦਾ ਦੇਖਦੀ ਹਾਂ ਖਬਰਾਂ ਵੀ ਦੇਖਦੀ ਹਾਂ ਸਭ ਕੁਝ ਮਤਲਬ ਕਿ ਆਪਾਂ ਦੇਖੀ ਦਾ ਹੈਗਾ ਹੈਗਾ ਤਾਂ ਜ਼ਿਆਦਾਤਰ ਕਿਉਂਕਿ ਮੈਂ ਦੇਖੀਦਾ ਵੱਖ ਵੱਖ ਚੈਨਲ ਜਿੱਦਾਂ ਅਜੀਤ ਹੋ ਗਿਆ ਅਜੀਤ ਚੈਨਲ ਮਤਲਬ ਕਿ ਐਂਕਰਿੰਗ ਦੇਖਦੀ ਹਾਂ ਮੈਂ ਤਾਂ ਖਬਰਾਂ ਦੀ ਬਹਿਸ ਵੀ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤਾਂ ਡੇਲੀ ਡੇਲੀ ਆਪਾਂ ਖਬਰਾਂ ਦੇਖੀ ਦੀਆਂ ਨੇ ਹੈ ਨਾ ਪਰ ਜ਼ਿਆਦਾਤਰ ਮੈਂ ਕੀ ਕਰਦੀ ਹੈਗੀ ਹੈਗੀ ਫੇਸਬੁਕ ਨੂੰ ਲਾਈਕ ਕਰਦੀ ਹਾਂ ਫੇਸਬੁਕ ਤੋਂ ਜ਼ਿਆਦਾਤਰ ਮੈਂ ਖਬਰਾਂ ਦੇਖਦੀ ਹਾਂ ਜਿੱਦਾਂ ਫੇਸਬੁੱਕ ਹੋ ਗਿਆ ਅੱਜ ਕੱਲ੍ਹ ਤਾਂ ਫੋਨਾਂ 'ਤੇ ਹੀ ਹੈ ਨਾ ਵੀ ਉਹ ਹੁੰਦਾ ਹੈਗਾ ਖਬਰਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੇ ਆਪਾਂ ਫੇਸਬੁੱਕ ਖੋਲ੍ਹਦੇ ਹਾਂ ਤਾਂ ਅੱਗੇ ਬਹੁਤ ਸਾਰੇ ਜਾਂ ਮੰਨ ਕੇ ਚਲੋ ਬਹਿਸ ਕਰਦੇ ਹੈਗੇ ਜ਼ਿਆਦਾਤਰ ਹੁਣ ਮੁੱਦਾ ਚੱਲ ਰਿਹਾ ਹੈਗਾ ਹੈ ਨਾ ਸਿੱਖ ਕੌਮ ਦਾ ਜਾਂ ਜਿੱਦਾਂ ਵੀ ਲਾ ਲਓ ਹੈ ਨਾ ਤਾਂ ਬਹਿਸ ਤਾਂ ਡੇਲੀ ਚੱਲਦੀ ਰਹਿੰਦੀ ਆ ਹੁਣ ਐਨਾ ਤਾਂ ਨਹੀਂ ਯਾਦ ਹੈਗਾ ਬਟ ਮੈਂ ਜ਼ਿਆਦਾਤਰ ਫੇਸਬੁੱਕ ਨੂੰ ਲਾਈਕ ਕਰਦੀ ਹਾਂ ਉੱਥੇ ਹੀ ਖਬਰਾਂ ਦੇਖਦੀ ਹਾਂ ਤਾਂ ਬਹਿਸ ਤਾਂ ਅੱਜ ਕੱਲ੍ਹ ਦੇਖੋ ਹੈ ਨਾ ਪੰਜਾਬ 'ਚ ਵੀ ਚੱਲ ਰਹੀ ਹੈ ਜਗ੍ਹਾ ਜਗ੍ਹਾ 'ਤੇ ਬਹਿਸ ਚਲ ਰਹੀ ਹੈਗੀ ਔਰ ਟੀ ਵੀ ਦੇ ਵਿੱਚ ਜਿਹੜੀਆਂ ਖਬਰਾਂ ਚੱਲਦੀਆਂ ਨੇ ਉਹਨਾਂ ਵਿੱਚ ਬਹਿਸ ਤਾਂ ਬਣਦੀ ਹੈ ਖਬਰਾਂ ਫਿਰ ਹੀ ਲੱਗਦੀਆਂ ਨੇ ਜੇ ਇੱਕ ਦੂਸਰੇ ਨਾਲ ਬਹਿਸ ਕਰਦੇ ਹੈਗੇ ਆ ਤਾਂ ਜ਼ਿਆਦਾਤਰ ਮੈ ਫੇਸਬੁੱਕ 'ਤੇ ਖਬਰਾਂ ਨੂੰ ਹੀ ਲਾਈਕ ਕਰਦੀ ਹਾਂ